ਛੋਟੇ ਹੁੰਦੇ ਤੋਂ ਹੀ ਜਦੋਂ ਮੈਂ ਆਪਣੇ ਦਾਦਾ ਜੀ ਨੂੰ ਦੇਖਦੀ ਸੀਗੀ ਬਾਗਬਾਨੀ ਕਰਦੇ ਉਹ ਇੰਨੀ ਖੂਬਸੂਰਤੀ ਦੇ ਨਾਲ ਫੁੱਲਾਂ ਫਲਾਂ ਅਤੇ ਸਬਜ਼ੀਆਂ ਅਤੇ ਜਿਹੜੇ ਰੁੱਖ ਨੇ ਉਹਨਾਂ ਨੂੰ ਲਗਾਉਂਦੇ ਸੀਗੇ ਔਰ ਉਹ ਲਹਿ ਲਹਾਉਂਦੇ ਹੋਏ ਫੁੱਲ ਜਦੋਂ ਆਪਣੀ ਖੂਬਸੂਰਤੀ ਦੇ ਨਾਲ ਖਿਲਦੇ ਸੀਗੇ ਤਾਂ ਇੰਨੇ ਜ਼ਿਆਦਾ ਖੂਬਸੂਰਤ ਲੱਗਦੇ ਸੀਗੇ ਕਿ ਉਹ ਮੇਰੇ ਲਈ ਇੱਕ ਪ੍ਰੇਰਨਾ ਦਾ ਕਾਰਨ ਬਣ ਗਏ ਮੈਂ ਉਹਨਾਂ ਨੂੰ ਰੋਜ਼ ਦੇਖਦੀ ਸੀਗੀ ਮੈਨੂੰ ਆਦਤ ਪੈ ਗਈ ਸੀ ਉਹਨਾਂ ਨੂੰ ਰੋਜ਼ ਦੇਖਣ ਦੀ ਔਰ ਬਾਗਬਾਨੀ ਦਾ ਸ਼ੌਂਕ ਤਾਂ ਮੇਰੇ ਦਾਦਾ ਜੀ ਨੂੰ ਸੀਗਾ ਉਹਨਾਂ ਤੋਂ ਬਾਅਦ ਜਦੋਂ ਮੈਂ ਉਹਨਾਂ ਦੇ ਨਾਲ ਰੋਜ਼ ਜਾਂਦੀ ਸੀਗੀ ਬਾਗ ਦੇ ਵਿੱਚ ਪਲਾਂਟਾਂ ਦੇ ਵਿੱਚ ਰੁੱਖਾਂ ਨੂੰ ਫੁੱਲਾਂ ਨੂੰ ਸਬਜ਼ੀਆਂ ਨੂੰ ਦੇਖਣ ਦੇ ਲਈ ਉਹਨਾਂ ਨੂੰ ਪਾਣੀ ਦੇਣ ਦੇ ਲਈ ਤਾਂ ਉਹਨਾਂ ਨੂੰ ਬਾਗਬਾਨੀ ਕਰਦੇ ਦੇਖ ਕੇ ਮੇਰੇ ਅੰਦਰ ਵੀ ਸ਼ੌਂਕ ਪੈਦਾ ਹੋਇਆ ਕਿਉਂਕਿ ਮੈਨੂੰ ਵੀ ਕੁਦਰਤ ਦੇ ਨਾਲ ਬਹੁਤ ਪਿਆਰ ਸੀਗਾ ਮੈਨੂੰ ਬਹੁਤ ਹੀ ਸੁੰਦਰ ਲੱਗਦੀ ਸੀਗੀ ਹਰਿਆਲੀ ਮੈਨੂੰ ਬਹੁਤ ਪਸੰਦ ਸੀਗੀ ਸੋ ਮੈਂ ਮੈਨੂੰ ਮੇਰੇ ਅੰਦਰ ਇੱਕ ਸ਼ੌਂਕ ਪੈਦਾ ਹੋਇਆ ਕਿ ਮੈਂ ਵੀ ਉਸਨੂੰ ਕਰਾਂ ਸੋ ਮੈਂ ਵੀ ਆਪਣੇ ਦਾਦਾ ਜੀ ਦੀ ਡੈੱਥ ਤੋਂ ਬਾਅਦ ਮੈਨ ਮੈਂ ਵੀ ਬਾਗਬਾਨੀ ਕਰਨੀ ਸ਼ੁਰੂ ਕੀਤੀ ਮੈਂ ਤਰ੍ਹਾਂ ਤਰ੍ਹਾਂ ਦੇ ਫੁੱਲ ਬੂਟੇ ਸਬਜ਼ੀਆਂ ਮੈਂ ਹਰ ਇੱਕ ਚੀਜ਼ ਆਪਣੇ ਘਰ ਔਰ ਆਪਣੇ ਪਲਾਂਟ ਦੇ ਵਿੱਚ ਲਵਾਉਣੀ ਸ਼ੁਰੂ ਕਰ ਦਿੱਤੀ ਉਹਨਾਂ ਦੀ ਦੇਖਭਾਲ ਕਰਦੀ ਹਾਂ ਮੈਂ ਉਹਨਾਂ ਨੂੰ ਰੋਜ਼ ਪਾਣੀ ਦਿੰਦੀ ਹਾਂ ਔਰ ਮੈਨੂੰ ਇਹ ਹਰਿਆਲੀ ਬਹੁਤ ਹੀ ਜ਼ਿਆਦਾ ਪਸੰਦ ਆ ਔਰ ਮੇਰੀ ਪ੍ਰੇਰਨਾ ਇਹੀ ਸੀਗੀ ਕਿ ਜਿਸ ਤਰ੍ਹਾਂ ਜੋ ਦਰੱਖਤ ਨੇ ਜੋ ਵੇਲਾਂ ਨੇ ਉਹ ਹਮੇਸ਼ਾ ਲਾਈਫ ਦੇ ਵਿੱਚ ਅੱਗੇ ਵੱਧਦੀਆਂ ਹੀ ਰਹਿੰਦੀਆਂ ਨੇ ਕਦੇ ਰੁਕਦੀਆਂ ਨਹੀਂ ਨੇ ਔਰ ਅਸੀਂ ਉਹਨਾਂ ਨੂੰ ਪਾਣੀ ਦਿੰਦੇ ਹਾਂ ਔਰ ਉਹ ਕਦੇ ਵੀ ਮੁਰਝਾਉਂਦੀਆਂ ਨਹੀਂ ਨੇ ਹਮੇਸ਼ਾ ਵੱਧਦੀਆਂ ਹੀ ਰਹਿੰਦੀਆਂ ਨੇ ਸੋ ਇਸੇ ਤਰ੍ਹਾਂ ਇਹਨਾਂ ਰੁੱਖਾਂ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ ਕਿ ਸਾਨੂੰ ਵੀ ਲਾਈਫ ਦੇ ਵਿੱਚ ਹਮੇਸ਼ਾ ਅੱਗੇ ਵੱਧਦੇ ਹੀ ਰਹਿਣਾ ਚਾਹੀਦਾ ਹੈ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਇਹ ਰੁੱਖ ਜਿਹੜੇ ਨੇ ਅਸੀਂ ਦੇਖਦੇ ਹਾਂ ਕਿ ਜਿਹੜਾ ਨਿਰਦਈ ਮਨੁੱਖ ਆ ਅੱਜ ਦਾ ਉਹ ਇਹਨਾਂ ਰੁੱਖਾਂ ਦੀ ਕਟਾਈ ਕਰ ਦਿੰਦਾ ਆ ਔਰ ਉਹ ਇਹਨਾਂ ਦੀਆਂ ਟਾਹਣੀਆਂ ਨੂੰ ਝਾੜ ਦਿੰਦਾ ਆ ਆਪਣੇ ਸਵਾਰਥ ਦੇ ਲਈ ਹੈ ਨਾ ਤੋ ਜਿਹੜੇ ਰੁੱਖ ਨੇ ਇਹ ਤਾਂ ਵੀ ਹਿੰਮਤ ਨਹੀਂ ਹਾਰਦੇ ਦੁਬਾਰਾ ਤੋਂ ਪੁੰਗਰਨਾ ਸ਼ੁਰੂ ਕਰ ਦਿੰਦੇ ਨੇ ਉਹ ਦੁਬਾਰਾ ਤੋਂ ਆਪਣੀਆਂ ਟਾਹਣੀਆਂ ਜਿਹੜੀਆਂ ਨੇ ਉਹ ਦੁਬਾਰਾ ਤੋਂ ਪੈਦਾ ਕਰਦੇ ਨੇ ਇਹਨਾਂ ਦੀਆਂ ਟਾਹਣੀਆਂ ਵੱਧਦੀਆਂ ਹੀ ਜਾਂਦੀਆਂ ਨੇ ਜਿੰਨੀ ਜ਼ਿਆਦਾ ਕਟਾਈ ਕਰਦੇ ਹਾਂ ਉਨਾਂ ਜ਼ਿਆਦਾ ਇਹਨਾਂ ਦੀ ਟਾਹਣੀਆਂ ਵੱਧਦੀਆਂ ਜਾਂਦੀਆਂ ਨੇ ਸੋ ਇਹਨਾਂ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ ਕਿ ਸਾਨੂੰ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਹਾਰਨਾ ਨਹੀਂ ਚਾਹੀਦਾ ਹਮੇਸ਼ਾ ਹਰ ਮੁਸ਼ਕਿਲ ਦਾ ਸਾਹਮਣਾ ਕਰਨਾ ਚਾਹੀਦਾ ਅੱਗੇ ਵੱਧਦੇ ਰਹਿਣਾ ਚਾਹੀਦਾ ਆ ਔਰ ਹਮੇਸ਼ਾ ਇਹ ਇਹਨਾਂ ਤੋਂ ਸਾਨੂੰ ਇੱਕ ਇਹ ਵੀ ਪ੍ਰੇਰਣਾ ਮਿਲਦੀ ਆ ਕਿ ਜੋ ਮਨੁੱਖ ਆ ਕਿੰਨਾ ਨਿਰਦਈ ਆ ਇੱਕ ਸਵਾਰਥੀ ਮਨੁੱਖ ਆ ਆਪਣੇ ਸਵਾਰਥ ਦੇ ਲਈ ਇਹ ਰੁੱਖ ਨੂੰ ਜਿਹੜਾ ਹੈ ਨਸ਼ਟ ਕਰ ਦਿੰਦਾ ਆ ਕੱਟ ਦਿੰਦਾ ਆ ਲੇਕਿਨ ਫਿਰ ਵੀ ਜੋ ਰੁੱਖ ਨੇ ਇਹ ਹਮੇਸ਼ਾ ਅੱਗੇ ਵੱਧਦੇ ਜਾਂਦੇ ਨੇ ਔਰ ਮਨੁੱਖ ਦੇ ਮਨੁੱਖ ਦੇ ਸੁੱਖ ਦਾ ਕਾਰਨ ਬਣਦੇ ਨੇ ਉਹਨਾਂ ਨੂੰ ਫਲ ਫੁੱਲ ਅਤੇ ਲੱਕੜੀਆਂ ਜਿਹੜੀਆਂ ਨੇ ਉਹ ਪ੍ਰਦਾਨ ਕਰਦੇ ਨੇ ਔਰ ਇਹ ਜਿਹੜੇ ਰੁੱਖ ਨੇ ਕਦੇ ਵੀ ਕਿਸੇ ਵੀ ਇਨਸਾਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ ਬਲਕਿ ਉਹਨਾਂ ਨੂੰ ਸੁੱਖ ਹੀ ਦਿੰਦੇ ਨੇ ਸੋ ਮੈਂ ਇਹੀ ਪ੍ਰੇਰਨਾ ਜਿਹੜੀ ਆ ਉਹ ਲਈ ਆ ਰੁੱਖਾਂ ਵੱਲ ਦੇਖ ਕੇ ਕਿ ਸਾਨੂੰ ਕਦੇ ਵੀ ਬਦਲੇ ਦੀ ਭਾਵਨਾ ਨਹੀਂ ਰੱਖਣੀ ਚਾਹੀਦੀ ਕੋਈ ਵੀ ਸਾਡੇ ਨਾਲ ਕਿੰਨਾ ਵੀ ਬੁਰਾ ਕਰੇ ਸਾਨੂੰ ਦੁੱਖ ਪਹੁੰਚਾਏ ਚੋਟ ਪਹੁੰਚਾਏ ਸਾਨੂੰ ਬਦਲੇ ਦੇ ਵਿੱਚ ਉਸਨੂੰ ਚੋਟ ਨਹੀਂ ਪਹੁੰਚਾਉਣੀ ਚਾਹੀਦੀ ਬਲਕਿ ਉਸ ਨੂੰ ਬਦਲੇ ਦੇ ਵਿੱਚ ਸੁੱਖ ਹੀ ਦੇਣਾ ਚਾਹੀਦਾ ਹੈ ਔਰ ਇਸ ਦੇ ਨਾਲ ਪਰਮਾਤਮਾ ਜਿਹੜਾ ਹੈ ਉਹ ਵੀ ਸਾਡੇ ਤੋਂ ਖੁਸ਼ ਰਹਿੰਦਾ ਹੈ ਔਰ ਸਾਨੂੰ ਇਸਦਾ ਫਲ ਦਿੰਦਾ ਹੈ ਸੋ ਇਹ ਜਿਹੜੇ ਰੁੱਖ ਨੇ ਉਹ ਸਾਡੇ ਲਈ ਬਹੁਤ ਹੀ ਵੱਡੀ ਪ੍ਰੇਰਨਾ ਦਾ ਕਾਰਨ ਬਣਦੇ ਨੇ ਇਹਨਾਂ ਤੋਂ ਸਾਨੂੰ ਸਾਹ ਜਿਹੜਾ ਆ ਉਹ ਆਕਸੀਜਨ ਜਿਹੜੀ ਆ ਉਹ ਸਾਨੂੰ ਵੱਡੀ ਮਾਤਰਾ ਦੇ ਵਿੱਚ ਮਿਲਦੀ ਆ ਸਾਨੂੰ ਸਾਹ ਦੀ ਕੋਈ ਬਿਮਾਰੀ ਨਹੀਂ ਲੱਗਦੀ ਔਰ ਇਹ ਸਾਡੀਆਂ ਬਹੁਤ ਸਾਰੀਆਂ ਜ਼ਰੂਰਤਾਂ ਨੂੰ ਵੀ ਪੂਰੀਆਂ ਕਰਦੇ ਨੇ ਸਾਨੂੰ ਲੱਕੜ ਪ੍ਰਦਾਨ ਕਰਦੇ ਨੇ ਸਾਨੂੰ ਫਲ ਫੁੱਲ ਸਬਜ਼ੀਆਂ ਦਿੰਦੇ ਨੇ ਸਾਨੂੰ ਠੰਡੀ ਛਾਂ ਠੰਡੀ ਹਵਾ ਦਿੰਦੇ ਨੇ ਰੁੱਖ ਹਰ ਤਰ੍ਹਾਂ ਦੇ ਨਾਲ ਸਾਡੀ ਜਿਹੜੀ ਆ ਸੁੱਖ ਦਾ ਭਾਗੀਦਾਰ ਬਣਦੇ ਨੇ ਸੋ ਸਾਨੂੰ ਇਹੀ ਪ੍ਰੇਰਣਾ ਮਿਲਦੀ ਆ ਇਹਨਾਂ ਰੁੱਖਾਂ ਤੋਂ ਕਿ ਇਹਨਾਂ ਦੇ ਵਾਂਗ ਸਾਨੂੰ ਹਮੇਸ਼ਾ ਜ਼ਿੰਦਗੀ ਦੇ ਵਿੱਚ ਅੱਗੇ ਵੱਧਦੇ ਰਹਿਣਾ ਚਾਹੀਦਾ ਔਰ ਸਭ ਦਾ ਭਲਾ ਕਰਨਾ ਚਾਹੀਦਾ ਆ ਬੁਰੇ ਦੇ ਬਦਲੇ ਕਦੇ ਵੀ ਬੁਰੇ ਦੀ ਭਾਵਨਾ ਨਹੀਂ ਰੱਖਣੀ ਚਾਹੀਦੀ ਬਲਕਿ ਸਾਨੂੰ ਬੁਰਿਆਂ ਦੇ ਨਾਲ ਵੀ ਅੱਛਾਈ ਦੇ ਨਾਲ ਪੇਸ਼ ਆਉਣਾ ਚਾਹੀਦਾ ਆ ਸੋ ਸਾਨੂੰ ਇਹੀ ਪ੍ਰੇਰਨਾ ਮਿਲਦੀ ਹੈ ਇਹਨਾਂ ਰੁੱਖਾਂ ਤੋਂ ਕਿ ਸਾਨੂੰ ਲਾਈਫ ਚ ਹਮੇਸ਼ਾ ਅੱਗੇ ਵੱਧਦੇ ਰਹਿਣਾ ਚਾਹੀਦਾ ਕਦੇ ਹਾਰ ਨਹੀਂ ਮੰਨਣੀ ਚਾਹੀਦੀ ਔਰ ਅਸੀਂ ਆਪਣੀ ਮੰਜ਼ਿਲ 'ਤੇ ਜ਼ਰੂਰ ਪਹੁੰਚਾਂਗੇ ਔਰ ਅਗਰ ਅਸੀਂ ਦੂਸਰਿਆਂ ਨੂੰ ਸੁੱਖ ਦਿੰਦੇ ਹਾਂ ਸਾਡੇ ਦੁਆਰਾ ਕੋਈ ਸੁਖੀ ਹੁੰਦਾ ਹੈ ਤਾਂ ਪਰਮਾਤਮਾ ਇਸਦਾ ਫਲ ਸਾਨੂੰ ਜ਼ਰੂਰ ਦਿੰਦਾ ਹੈ